ਪੰਜਾਬ ਮਤਲਬ ਇੱਕ ਇਹੋ ਜਿਹਾ ਦੇਸ਼ ਹੈਗਾ ਜਿਹਦੇ ਵਿੱਚ ਮਤਲਬ ਕਿ ਆਪਾਂ ਅਗਰ ਕੋਈ ਵੀ ਕਿਸੇ ਨੂੰ ਡਿਫੀਕਲਟੀ ਆਉਂਦੀ ਹੈ ਤਾਂ ਜਿਹੜਾ ਪੰਜਾਬ ਇੱਕ ਇਹੋ ਜਿਹਾ ਖੇਤਰ ਹੈਗਾ ਜਿਹੜਾ ਮਤਲਬ ਕਿ ਉਹਨਾਂ ਦੀ ਹੈਲਪ ਕਰਦਾ ਕਿਸੇ ਵੀ ਆ ਜਿੱਦਾਂ ਹੁਣ ਅੱਜ ਕੱਲ੍ਹ ਬੜਾ ਪਿਛਲੀ ਵਾਰੀ ਕੇਰਲਾ ਜਾਂ ਏਸ਼ੀਆ ਕੇਰਲਾ ਵਿੱਚ ਫਲੱਡ ਆ ਗਿਆ ਸੀਗਾ ਉੜੀਸਾ ਵਿੱਚ ਫਲੱਡ ਆ ਗਿਆ ਸੀ ਤਾਂ ਮਤਲਬ ਕਿ ਜਿਹੜੀ ਸਾਡੀ ਪੰਜਾਬ ਦੀ ਸਰਕਾਰ ਹੈਗੀ ਆ ਜਿਵੇਂ ਕਿ ਉਹਨਾਂ ਨੇ ਮਤਲਬ ਉਹ ਕਦੀ ਵੀ ਕਿਸੇ ਦੀ ਹੈਲਪ ਕਰਨ ਤੋਂ ਪਿੱਛੇ ਨਹੀਂ ਰਹਿੰਦੇ ਅਤੇ ਜਿਵੇਂ ਇੱਕ ਮਤਲਬ ਇਹਨਾਂ ਨੇ ਇੱਕ ਸੁਸਾਈਟੀ ਵੀ ਬਣਾਈ ਹੈ ਖਾਲਸਾ ਏਡ ਵਾਲੀ ਉਹ ਸਾਡੇ ਮਤਲਬ ਲੋਕਾਂ ਦੀ ਹੈਲਪ ਉਹਨਾਂ ਨੇ ਕੇਰਲਾ ਦੇ ਲੋਕਾਂ ਦੀ ਹੈਲਪ ਕੀਤੀ ਉਹਨਾਂ ਨੂੰ ਫਲੱਡ ਤੋਂ ਬਚਾਇਆ ਉਹਨਾਂ ਦੀ ਮਤਲਬ ਉਹਨਾਂ ਨੂੰ ਫੂਡ ਪ੍ਰੋਵਾਈਡ ਕੀਤਾ ਉਹਨਾਂ ਦੇ ਜਿਹੜੇ ਮਤਲਬ ਘਰ ਸੀਗੇ ਉਹਨਾਂ ਨੂੰ ਬਚਾਇਆ ਮਤਲਬ ਜਿਹੜੇ ਪੰਜਾਬ ਦੇ ਲੋਕ ਹੈਗੇ ਆ ਉਹ ਮਤਲਬ ਕਿ ਕਦੀ ਵੀ ਪਿੱਛੇ ਨਹੀਂ ਹੱਟਦੇ ਕਿਸੇ ਵੀ ਹਿੰਦੂ ਧਰਮ ਸਿੱਖ ਧਰਮ ਇਸਾਈ ਆ ਕਿਸੇ ਦੀ ਵੀ ਮਤਲਬ ਹੈਲਪ ਕਰਨ ਤੋਂ ਪਿੱਛੇ ਨਹੀਂ ਹੱਟਦੇ ਉਹ ਸਾਰਿਆਂ ਦੀ ਹੈਲਪ ਕਰਦੇ ਆ ਸੋ ਮਤਲਬ ਕਿ ਮੈਨੂੰ ਵੀ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੁੰਦਾ ਹੈ ਕਿ ਮੈਂ ਵੀ ਇੱਕ ਪੰਜਾਬੀ ਹਾਂ ਕਿਉਂਕਿ ਪੰਜਾਬੀ ਇੱਕ ਹਿਊਮਨ ਹਾਰਟ ਪਰਸਨ ਹੁੰਦੇ ਆ ਅਤੇ ਉਹ ਬੜੇ ਸੋਫਟ ਮਾਈਂਡ ਸੋਫਟ ਹਾਰਟਡ ਅਤੇ ਬੜੇ ਹੀ ਮਤਲਬ ਖੁੱਲ੍ਹੇ ਦਿਲ ਦੇ ਇਨਸਾਨ ਹੁੰਦੇ ਆ ਜਿਹੜੇ ਮਤਲਬ ਕਿ ਕਦੀ ਵੀ ਕਿਸੇ ਵੀ ਲੋੜਮੰਦ ਇਨਸਾਨ ਦੀ ਮਦਦ ਕਰਨ ਤੋਂ ਪਿੱਛੇ ਨਹੀਂ ਹੱਟਦੇ